ਕਿਸੇ ਖੇਤਰ ਦੀ ਪਹਿਚਾਣ ਹੀ ਉਸਦੀ ਭਾਸ਼ਾ ਹੁੰਦੀ ਹੈ ਭਾਸ਼ਾ ਇੱਕ ਸਮਾਜ ਦਾ ਇੱਕ ਵਿਅਕਤੀ ਦੇ ਇੱਕ ਮੁੱਢਲੀ ਇਕਾਈ ਹੁੰਦੀ ਹੈ ਭਾਸ਼ਾ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਖੇਤਰ ਦਾ ਕਿਹੋ ਜਿਹਾ ਰਹਿਣ ਸਹਿਣ ਹੈ ਕਿਹੋ ਜਿਹਾ ਸੱਭਿਆਚਾਰ ਹੈ ਕਿਵੇਂ ਦੇ ਰੀਤੀ ਰਿਵਾਜ਼ ਹਨ ਭਾਸ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਿਵੇਂ ਕਿ ਅਸੀਂ ਪੁਆਧੀ ਤੋਂ ਪੁਆਧੀ ਖੇਤਰ ਤੋਂ ਬਿਲੋਂਗ ਕਰਦੇ ਹਾਂ ਸਾਡੇ ਇਸ ਏਰੀਏ ਵਿੱਚ ਪੁਆਧੀ ਬੋਲੀ ਜਾਂਦੀ ਹੈ ਪਰ ਇੱਕ ਵਾਰ ਮੈਂ ਕਿਸੇ ਫੰਕਸ਼ਨ 'ਤੇ ਅੰਮ੍ਰਿਤਸਰ ਗਈ ਹੋਈ ਸੀ ਉੱਥੇ ਮਲਵਈ ਮਾਝੀ ਭਾਸ਼ਾ ਬੋਲੀ ਜਾਂਦੀ ਹੈ ਜੋ ਬੋਲਣ ਵਿੱਚ ਵੀ ਬਿਲਕੁਲ ਅਲੱਗ ਹੈ ਅਤੇ ਉਹ ਸੁਣਨ ਵਿੱਚ ਇੰਨੀ ਜ਼ਿਆਦਾ ਵਧੀਆ ਲੱਗਦੀ ਹੈ ਕਿ ਦਿਲ ਖੁਸ਼ ਹੋ ਜਾਂਦਾ ਹੈ ਮੇਰਾ ਵੀ ਦਿਲ ਕੀਤਾ ਕਿ ਮੈਂ ਉਹ ਭਾਸ਼ਾ ਅਪਣਾਵਾਂ ਬੋਲਾਂ ਪਰ ਜਦੋਂ ਹੀ ਮੈਂ ਅੰਮ੍ਰਿਤਸਰ ਤੋਂ ਕੁਝ ਥੋੜ੍ਹੀ ਦੂਰ 'ਤੇ ਆਈ ਤਾਂ ਉਹ ਹੀ ਭਾਸ਼ਾ ਬਦਲ ਗਈ ਤਾਂ ਸਾਨੂੰ ਇੱਥੇ ਤੋਂ ਐਵੇਂ ਪਤਾ ਲੱਗਦਾ ਹੈ ਕਿ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਜਾਂਦੇ ਹਾਂ ਹ ਹੋਰ ਇਲਾਕਿਆਂ ਵਿੱਚ ਜਾਂਦੇ ਹਾਂ ਉਹਨਾਂ ਦੀ ਆਪਣੀਆਂ ਉਪਭਾਸ਼ਾਵਾਂ ਹਨ ਜਿਵੇਂ ਕਿ ਅਸੀਂ ਇੱਧਰ ਬਠਿੰਡੇ ਮਾਨਸੇ ਦੀ ਸਾਈਡ ਚਲ ਜਾਈਏ ਉੱਥੇ ਮਾਲਵੇ ਦਾ ਖੇਤਰ ਪੈਂਦਾ ਅਤੇ ਉੱਥੇ ਮਲਵਈ ਭਾਸ਼ਾ ਬੋਲੀ ਜਾਂਦੀ ਹੈ ਐਵੇਂ ਹੀ ਅਸੀਂ ਪਟਿਆਲੇ ਵਾਲੀ ਸਾਈਡ ਆ ਜਾਵੇ ਉੱਥੇ ਦੀ ਭਾਸ਼ਾ ਵਿੱਚ ਹੋਰ ਫਰਕ ਹੈ ਉਹ ਸੀ ਦੀ ਵਰਤੋਂ ਜ਼ਿਆਦਾ ਕਰਦੇ ਹਨ ਐਵੇਂ ਹੀ ਸਾਰੇ ਇਲਾਕਿਆਂ ਵਿੱਚ ਅਲੱਗ ਅਲੱਗ ਪ੍ਰਕਾਰ ਦੀਆਂ ਉਹ ਭੋਲੀਆਂ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਸਭ ਦੇ ਇਲਾਕੇ ਦੀ ਆਪਣੀ ਇੱਕ ਭਾਸ਼ਾ ਹੈ ਅਤੇ ਇਹ ਹੀ ਉਹਨਾਂ ਦੀ ਇੱਕ ਪਹਿਚਾਣ